ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਮਤਲਬ ਕਿ ਇੱਥੇ ਖਾਣ ਪੀਣ ਦੀ ਕੋਈ ਤੰਗੀ ਨਹੀਂ ਅੱਛੇ ਅੱਛੇ ਰੈਸਟੋਰੈਂਟ ਆ ਜਿੱਦਾਂ ਕਿ ਤੁਸੀਂ ਸਾਂਝੇ ਚੁੱਲੇ ਚੱਲ ਜਾਓ ਉਹ ਵੀ ਅੱਛਾ ਵਧੀਆ ਰੈਸਟੋਰੈਂਟ ਹੈ ਕੋਰਲ ਚਲ ਜਾਓ ਅੱਛਾ ਰੈਸਟੋਰੈਂਟ ਹੈ ਮਤਲਬ ਕਿ ਔਰ ਤੁਹੀ ਡੋਨ ਟੋਨ ਚੱਲ ਜਾਓ ਇੱਥੇ ਵੀ ਵਧੀਆ ਖਾਣਾ ਤੁਹਾਨੂੰ ਫਰੈਸ਼ ਇਕਦਮ ਮਿਲੇਗਾ ਵਧੀਆ ਹਾਂਜੀ ਹਾਂਜੀ ਹਾਂਜੀ ਬਿਲਕੁਲ ਜਾਇਜ਼ ਰੇਟ ਹੈ ਔਰ ਇਕਦਮ ਫਰੈਸ਼ ਮਤਲਬ ਕਿ ਤੁਹਾਨੂੰ ਸਮਾਨ ਸਾਰਾ ਮਿਲੇਗਾ ਖਾਣ ਪੀਣ ਦਾ ਕੋਈ ਕੰਪਲੇਨ ਨਹੀਂ ਹੈ ਸਰ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਸਾਰਾ ਹਰ ਇੱਕ ਚੀਜ਼ ਚੈੱਕ ਕਰਕੇ ਹੀ ਤੁਹਾਡੇ ਤੱਕ ਪੁੱਜੀ ਜਾਵੇਗੀ ਜੀ ਬਿਲਕੁਲ ਫਰੈਸ਼ ਸਮਾਨ ਮਿਲੇਗਾ ਕੋਈ ਵੀ ਕੰਪਲੇਨ ਹੋਵੇਗੀ ਤੁਸੀਂ ਇੱਥੇ ਖੁੱਲ ਕੇ ਗੱਲ ਕਰ ਸਕਦੇ ਹੋ ਸਰ ਇੱਕਦਮ ਬਿਲਕੁਲ ਫਰੈਸ਼ ਸਮਾਨ ਹੈ ਔਰ ਗਰੰਟੀ ਹੈ ਹਾਂਜੀ ਠੀਕ ਹੈ ਸਰ ਓਕੇ